ਨਮਸਕਾਰ ਮੇਰਾ ਨਾਮ ਸਾਕਸ਼ੀ ਹੈ ਅਤੇ ਮੈਂ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਭਾਰਤ ਵਿੱਚ ਲੋਕ ਕਈ ਸੱਭਿਆਚਾਰਕ ਪਰੰਪਰਾਵਾਂ 'ਤੇ ਕਾਫ਼ੀ ਜ਼ਿਆਦਾ ਵਿਸ਼ਵਾਸ ਰੱਖਦੇ ਹਨ ਭਾਰਤ ਦੇ ਲੋਕ ਕਾਫ਼ੀ ਵਹਿਮਾਂ ਭਰਮਾਂ ਵਿੱਚ ਵੀ ਵਿਸ਼ਵਾਸ ਰੱਖਦੇ ਹਨ ਅਤੇ ਇਹ ਹਰ ਪਰੰਪਰਾ ਨੂੰ ਚੰਗੇ ਤਰੀਕੇ ਨਾਲ ਮੰਨਦੇ ਹਨ ਭਾਰਤ ਦੇ ਲੋਕ ਕਾਫ਼ੀ ਜ਼ਿਆਦਾ ਵੱਖਰੇ ਹਨ ਕਿਉਂਕਿ ਉਹ ਹਰ ਧਰਮ ਦੇ ਲੋਕ ਕਿਉਂਕਿ ਹਰ ਧਰਮ ਦੇ ਲੋਕ ਭਾਰਤ ਵਿੱਚ ਰਹਿੰਦੇ ਹਨ ਜਿਵੇਂ ਹਿੰਦੂ ਮੁਸਲਿਮ ਸਿੱਖ ਅਤੇ ਈਸਾਈ ਅਤੇ ਇਹ ਲੋਕ ਸਾਰੇ ਆਪਸੀ ਭਾਈਚਾਰੇ ਨਾਲ ਰਹਿੰਦੇ ਹਨ ਅਤੇ ਇੱਕ ਦੂਜੇ ਨਾਲ ਇਹ ਸਹਿਮਤੀ ਬਣਾਈ ਰੱਖਦੇ ਹਨ ਭਾਰਤ ਦੇ ਲੋਕ ਇੱਕ ਦੂਜੇ ਨਾਲੋਂ ਧਰਮਾਂ ਤੋਂ ਭਿੰਨ ਹਨ ਪਰੰਤੂ ਉਹ ਤਾਂ ਵੀ ਇੱਕ ਦੂਜੇ ਦੇ ਧਰਮਾਂ ਦੀ ਆਗਿਆ ਦਾ ਪਾਲਨ ਕਰਦੇ ਹਨ ਅਤੇ ਉਹ ਹਰ ਇੱਕ ਦੇ ਧਰਮ ਦਾ ਨ ਨਾ ਉੱਚਾ ਸਮਝਦੇ ਹਨ ਹਰ ਧਰਮ ਦੇ ਲੋਕ ਜਿਹੜੇ ਹੁੰਦੇ ਹਨ ਉਹ ਸਾਰਿਆਂ ਨਾਲ ਸਹਿਮਤੀ ਬਣਾਈ ਰੱਖਦੇ ਹਨ ਕੋਈ ਵੀ ਧਰਮ ਦਾ ਲੋਕ ਆਪਣੇ ਆਪ ਨੂੰ ਉੱਚਾ ਜਾਂ ਨੀਵਾਂ ਨਹੀਂ ਮੰਨਦਾ ਇਸ ਲਈ ਇਸ ਤਰ੍ਹਾਂ ਭਾਰਤ ਜਿਹੜਾ ਹੈ ਇਹ ਕਾਫ਼ੀ ਜ਼ਿਆਦਾ ਪਰੰਪਰਾਵਾਂ ਦਾ ਦੇਸ਼ ਹੈ ਅਤੇ ਇਸ ਦਾ ਸੱਭਿਆਚਾਰ ਸਾਰੇ ਧਰਮਾਂ ਨਾਲੋਂ ਕਾਫ਼ੀ ਜ਼ਿਆਦਾ ਵੱਖ ਹੈ ਕਿਉਂਕਿ ਇੱਥੋਂ ਦੇ ਲੋਕ ਹਰ ਧਰਮ ਦਾ ਪਾਲਣ ਕਰਦੇ ਹਨ ਧੰਨਵਾਦ